ਜਦੋਂ ਵੀ ਅਸੀਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਾਣੀ ਨੂੰ ਮ ਪਾਣੀ ਨੂੰ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਆਪਾਂ ਇਕੱਠਾ ਇਸ ਤਰ੍ਹਾਂ ਨਾ ਕੋਈ ਡਰੰਮ ਜਾਂ ਕੋਈ ਟੱਬ ਵਿੱਚ ਇਕੱਠਾ ਕਰ ਸਕਦੇ ਹਾਂ ਅਤੇ ਜਾਂ ਆਪਾਂ ਬਾਹਰੋਂ ਬੋਤਲਾਂ ਵਗੈਰਾ ਪਾਣੀ ਦੀਆਂ ਫਿਲਟਰ ਫਿਲਟਰ ਕੈਂਪਰ ਮੰਗਵਾ ਸਕਦੇ ਹਾਂ ਅਤੇ ਜੇ ਗਰਮੀ ਹੈ ਤਾਂ ਆਪਾਂ ਪਾਣੀ ਨੂੰ ਠੰਡਾ ਰੱਖਣਾ ਹੈ ਤਾਂ ਉਸ ਵਿੱਚ ਬਰਫ਼ ਪਾ ਕੇ ਪਾਣੀ ਨੂੰ ਠੰਡਾ ਰੱਖ ਸਕਦੇ ਹਾਂ ਜੇ ਸਰਦੀ ਹੈ ਤਾਂ ਪਾਣੀ ਨੋਰਮਲ ਪਾਣੀ ਸਿੰਪਲ ਪਾਣੀ ਆਪਾਂ ਘਰ ਪਾਣੀ ਇਕੱਠਾ ਕਰਕੇ ਉਹ ਪਾਣੀ ਦੀ ਵਰਤੋਂ ਕਰਦੇ ਹਾਂ ਅਤੇ ਉਹ ਪਾਣੀ ਆਪਾਂ ਪੀਂਦੇ ਹਾਂ ਇ ਇਕਣੇ ਛੋਟੇ ਵੱਡੇ ਪ੍ਰੋਗਰਾਮਾਂ ਵਿੱਚ ਕੋਈ ਜਨਮਦਿਨ ਵਗੈਰਾ ਕੋਈ ਬਰਡੇ ਪਾਰਟੀ ਕੁਛ ਵੀ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਪਾਣੀ ਦੀ ਵਰਤੋਂ ਕਰ ਸਕਦੇ ਹਾਂ ਪਾਣੀ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਨ੍ਹਾਂ ਵਿੱਚ